ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅਸੀਂ ਸਰਬੱਤ ਦਾ ਭਲਾ ਬੋਲਦੇ ਹਾਂ ਸਾਰਿਆਂ ਦਾ ਭਲਾ ਹੀ ਕਰਦੇ ਹਾਂ ਜੀ ਹਾਂਜੀ ਹਾਂਜੀ ਬੋਲੋ ਜੀ ਵਾਹਿਗੁਰੂ ਜੀ ਠੀਕ ਹੈ ਠੀਕ ਹੈ ਠੀਕ ਹੈ ਬਜ਼ੁਰਗੋ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਕੋਈ ਗੱਲ ਨਹੀਂ ਬਾਬਾ ਜੀ ਅਸੀਂ ਤੁਹਾਡੀ ਜਿੰਨੀ ਵੀ ਹੋ ਸਕੀ ਵੱਧ ਤੋਂ ਵੱਧ ਮਦਦ ਕਰਾਂਗੇ ਤੁਹਾਨੂੰ ਅਸੀਂ ਦਵਾਈ ਬੂਟੀ ਵੀ ਦਵਾਵਾਂਗੇ ਜੇ ਤੁਹਾਡਾ ਕੋਈ ਰਹਿਣ ਦਾ ਬਸੇਰਾ ਨਹੀਂ ਹੈਗਾ ਤਾਂ ਆਪਣੇ ਕੋਲ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਕੋਲ ਰਹਿਣ ਬਸੇਰਾ ਵੀ ਚੱਲਦਾ ਗਾ ਅਤੇ ਤੁਹਾਨੂੰ ਅਸੀਂ ਇਹਦੇ ਵਿੱਚ ਸੈਂਟਰ ਦੇ ਵਿੱਚ ਜਿਹੜਾ ਸਾਡਾ ਰਹਿਣ ਬਸੇਰਾ ਬਣਾਇਆ ਹੋਇਆ ਉਹਦੇ ਵਿੱਚ ਤੁਹਾਨੂੰ ਅਸੀਂ ਉੱਥੇ ਲਿਆਵਾਂਗੇ ਵੀ ਤੁਹਾਡੀ ਸੇਵਾ ਵੀ ਕਰਾਂਗੇ ਸਾਡੇ ਇੱਥੇ ਰੱਖੇ ਹੋਏ ਨੇ ਸਪੈਸ਼ਲ ਵਰਕਰ ਅਤੇ ਤੁਹਾਨੂੰ ਸਵੇਰੇ ਨਵਾਉਣਗੇ ਖਾਣਾ ਵੀ ਖਵਾਉਣਗੇ ਕੱਪੜੇ ਵੀ ਧੋਤੇ ਹੋਏ ਮਿਲਣਗੇ ਦਵਾਈ ਬੂਟੀ ਮਿਲੂਗੀ ਜੀ ਤੁਹਾਡੇ ਕੋਈ ਅਪ੍ਰੇਸ਼ਨ ਵਗੈਰਾ ਦੀ ਲੋੜ ਹੈ ਤੁਹਾਨੂੰ ਉਹ ਵੀ ਮਿਲੂਗੀ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਸਾਰਿਆਂ ਦਾ ਭਲਾ ਕਰਦੇ ਐਂਗੇ ਅਤੇ ਪਰਮਾਤਮਾ ਸਾਡੇ ਤੋਂ ਇਹ ਸੇਵਾ ਕਰਵਾ ਰਿਹਾ ਗਾ ਤੁਸੀਂ ਬੇਫਿਕਰ ਹੋ ਜਾਓ ਜੀ ਤੁਸੀਂ ਬਿਲਕੁਲ ਤੁਹਾਨੂੰ ਸਹੀ ਨੰਬਰ ਦਿੱਤਾ ਗਿਆ ਗਾ ਅਤੇ ਕੋਈ ਗੱਲ ਨਹੀਂ ਜੇ ਤੁਹਾਡੇ ਬੱਚੇ ਨਹੀਂ ਸਿਆਣਦੇ ਤੁਸੀਂ ਸਾਨੂੰ ਇੱਕ ਜ਼ਰੀਆ ਆਪਾਂ ਨੂੰ ਬਣਾਇਆ ਉਹ ਬੰਦੇ ਨੇ ਅਤੇ ਅਸੀਂ ਤੁਹਾਨੂੰ ਲੈ ਜਾਂਗੇ ਸਾਨੂੰ ਅਡਰੈਸ ਤੁਸੀਂ ਆਪਣਾ ਸੈਂਡ ਕਰ ਦਿਓ ਤੁਹਨੂੰ ਜਿਸ ਤਰ੍ਹਾਂ ਦੀ ਲੋੜ ਹੋਵੇਗੀ ਅਸੀਂ ਉਸ ਤਰ੍ਹਾਂ ਕਰਾਂਗੇ ਪਹਿਲਾਂ ਤੁਸੀਂ ਆਪਣੇ ਮਨ ਨਾਲ ਸਲਾਹ ਕਰ ਲਿਓ ਵੀ ਤੁਸੀਂ ਇਹ ਸੰਸਥਾ ਵਿੱਚ ਆਉਣਾ ਚਾਹੁੰਦੇ ਹੋ ਗੇ ਜੇ ਤੁਸੀਂ ਘਰ ਬਹਿ ਕੇ ਵੀ ਆਪਣਾ ਅਰਾਮ ਕਰਨਾ ਚਾਹੁੰਦੇ ਹੋ ਅਸੀਂ ਤੁਹਾਨੂੰ ਘਰ ਬਹਿ ਕੇ ਵੀ ਅਪ੍ਰੇਸ਼ਨ ਵਗੈਰਾ ਜਾਂ ਦਵਾਈਆਂ ਜਾਂ ਕੋਈ ਰਾਸ਼ਨ ਪਾਣੀ ਦੀ ਲੋੜ ਐਗੀ ਅਸੀਂ ਤੁਹਾਨੂੰ ਉਹ ਵੀ ਪ੍ਰੋਵਾਈਡ ਕਰ ਸਕਦੇ ਐਗੇ ਤੁਸੀਂ ਦੱਸੋ ਜੀ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਚਾਹੀਦਾ ਜੀ

ਕੋਈ ਗੱਲ ਨਹੀਂ ਬਾਬਾ ਜੀ ਸਾਡੇ ਕੋਲ ਇੱਥੇ ਲੁਧਿਆਣਾ ਤੋਂ ਆਪਣੇ ਡੀ ਐੱਮ ਸੀ 'ਚ ਡਾਕਟਰ ਸਾਹਿਬ ਆਉਂਦੇ ਨੇ ਗੇ ਅਤੇ ਅਸੀਂ ਆਦੇਸ਼ ਹੌਸਪੀਟਲ ਤੋਂ ਵੀ ਬੁਲਾਉਂਦੇ ਐਂਗੇ ਅਤੇ ਇੱਧਰੋਂ ਆਪਣਾ ਪੀ ਜੀ ਆਈ ਚੰਡੀਗੜ੍ਹ ਤੋਂ ਵੀ ਬੁਲਾਉਂਦੇ ਹਾਂਜੀ ਹਾਂਜੀ ਅਤੇ ਤੁਹਾਡਾ ਇਲਾਜ ਬਹੁਤ ਵਧੀਆ ਬਾਬਾ ਜੀ ਹੋਵੇਗਾ ਅਤੇ ਪਹਿਲਾਂ ਕੋਈ ਲੈਂਜ ਵਗੈਰਾ ਪਏ ਹੋਏ ਨੇ ਤੁਹਾਡੀਆਂ ਅੱਖਾਂ ਦੇ ਵਿੱਚ ਕੋਈ ਗੱਲ ਨਹੀਂ ਅਸੀਂ ਤੁਹਾਡਾ ਬਹੁਤ ਵਧੀਆ ਇਲਾਜ ਕਰਾਂਗੇ ਬਾਕੀ ਤੁਹਾਡਾ ਜਿਹੜਾ ਖੰਘ ਵਗੈਰਾ ਹੋਈ ਹੋਈ ਹੈ ਤੁਸੀਂ ਇਹਦੀ ਵਾਸਤੇ ਅਸੀਂ ਤੁਹਾਨੂੰ ਮੈਡੀਸਨ ਮੈਂ ਕੱਲ੍ਹ ਨੂੰ ਮੁੰਡੇ ਨੂੰ ਭੇਜ ਦਾਂਗਾ ਅਤੇ ਖੰਘ ਤੋਂ ਬਿਨਾਂ ਤੁਹਾਨੂੰ ਕੋਈ ਕੋਈ ਹੋਰ ਪ੍ਰੋਬਲਮ ਕੋਈ ਇਹ ਖੰਘ ਕਿੰਨੇ ਕੁ ਟੈਮ ਦੀ ਪੁਰਾਣੀ ਹੈ ਜੀ ਤੁਹਾਨੂੰ ਹਾਂ ਹਾਂ ਮੌਸਮ ਚੇਂਜ ਚੇਂਜ ਨਾ ਹੋਣ ਨਾਲ ਹੋ ਜਾਂਦਾ ਜੀ ਬਾਬਾ ਜੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਜਿੰਨੇ ਸਾਸ ਗਿਰਾਸ ਲਿਖੇ ਨੇ ਜੀ ਪਰਮਾਤਮਾ ਨੇ ਅਤੇ ਓਨਾ ਟੈਮ ਹੈਗਾ ਅਸੀਂ ਤੁਹਾਡੀ ਵਧੀਆ ਸੇਵਾ ਕਰਾਂਗੇ ਸਾਨੂੰ ਤਾਂ ਪਰਮਾਤਮਾ ਨੇ ਮੌਕਾ ਦਿੱਤਾ ਗਾ ਅਤੇ ਬਜ਼ੁਰਗਾਂ ਦੀ ਸੇਵਾ ਕਰਨਾ ਸਾਡਾ ਮੁੱਖ ਉਦੇਸ਼ ਇਹ ਹੀ ਹੈ ਬਜ਼ੁਰਗਾਂ ਦੀ ਸੇਵਾ ਕਰਨਾ ਅਤੇ ਅਸੀਂ ਤੁਹਾਡੀ ਸੇਵਾ ਕਰਾਂਗੇ ਸਰ ਤੁਸੀਂ ਆਪਣੀ ਰਾਇ ਬਣਾ ਕੇ ਦੱਸ ਦਿਓ ਵੀ ਕਿੱਦਾਂ ਆਉਣਾ ਚਾਹੁੰਦੇ ਹੋ ਜਾਂ ਕਿਵੇਂ ਵੀ ਹਾਂ ਠੀਕ ਠੀਕ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਜੀ ਓਕੇ ਓਕੇ ਓਕੇ ਠੀਕ ਹੈ ਜੀ ਓਕੇ